ਮੇਰੀ ਪਸੰਦੀਦਾ ਤੈਰਾਕੀ ਮੰਜ਼ਿਲ ਮੋਹਾਲੀ ਸ ਸਪੋਟਸ ਕੰਪਲੈਕਸ ਵਿੱਚ ਹੈ ਜੋ ਕਿ ਮੋਹਾਲੀ ਵਿੱਚ ਹੀ ਸਥਿਤ ਹੈ ਇੱਥੇ ਜਦੋਂ ਵੀ ਵੀਕਐਂਡਜ਼ ਵਗੈਰਾ 'ਤੇ ਮੈਂ ਫਰੀ ਹੁੰਦੀ ਹਾਂ ਤਾਂ ਉੱਥੇ ਮੈਂ ਤੈਰਾਕੀ ਕਰਨ ਲਈ ਚਲੀ ਜਾਂਦੀ ਹਾਂ ਉੱਥੇ ਵੁਮੈਨਜ਼ ਅਤੇ ਮੈਨ ਲਈ ਅਲੱਗ ਡਿਪਾਰਟਮੈਂਟ ਹੈ ਜਿੱਥੇ ਆਪਣੀ ਤੈਰਾਕੀ ਦੀ ਪ੍ਰੈਕਟਿਸ ਕਰ ਸਕਦੀ ਹਾਂ ਮੈਂ ਅਤੇ ਹੋਰ ਵੀ ਬਹੁਤ ਸਪੋਟਸ ਅਵੇਲੇਬਲ ਹਨ ਅਤੇ ਉੱਥੇ ਕੋਈ ਵੀ ਜੋ ਵੀ ਦਿਲ ਕਰਦਾ ਹੈ ਉਹ ਇੰਨਜੋਏ ਕਰ ਸਕਦੇ ਹਨ